ਨਮਸਕਾਰ ਮੇਰਾ ਨਾਮ ਸਾਕਸ਼ੀ ਹੈ ਤੇ ਮੈਂ ਪਠਾਨਕੋਟ ਜ਼ਿਲ੍ਹੇ ਦੀ ਰਹਿਣ ਵਾਲੀ ਹਾਂ ਅੱਜ ਮੈਂ ਤੁਹਾਨੂੰ ਪਠਾਨਕੋਟ ਬਾਰੇ ਕੁਝ ਚੀਜ਼ਾਂ ਦੱਸਣਾ ਚਾਹਵਾਂਗੀ ਜਿਵੇਂ ਕਿ ਪਠਾਨਕੋਟ ਵਿੱਚ ਸਰ ਨਾਲੋਂ ਫੇਮਸ ਮੰਦਿਰ ਹੈ ਜੋ ਕਿ ਸ਼ਿਵਜੀ ਭਗਵਾਨ ਜੀ ਦਾ ਮੰਦਿਰ ਹੈ ਮਕੇਸਰਾ ਮੁੱਖਤੇਸ਼ਵਰ ਧਾਮ ਟੈਂਪਲ ਜਿਹਨੂੰ ਕਿਹਾ ਜਾਂਦਾ ਹੈ ਇਹ ਬਹੁਤ ਹੀ ਜ਼ਿਆਦਾ ਫੇਮਸ ਹੈ ਲੋਕ ਇੱਥੇ ਬਹੁਤ ਸ਼ਰਧਾ ਨਾਲ ਜਾਂਦੇ ਹਨ ਅਤੇ ਭਗਵਾਨ ਦੀ ਪੂਜਾ ਅਰਚਨਾ ਕਰਦੇ ਹਨ ਇੱਥੇ ਮੇਲਾ ਵੀ ਲੱਗਦਾ ਹੈ ਸ਼ਿਵਰਾਤਰੀ ਵਾਲੇ ਦਿਨ ਅਤੇ ਇਹ ਮੰਦਰ ਬਹੁਤ ਹੀ ਜ਼ਿਆਦਾ ਵੱਡਾ ਹੈ ਅਤੇ ਬਹੁਤ ਹੀ ਜ਼ਿਆਦਾ ਸੋਹਣਾ ਹੈ ਇਸ ਦਾ ਇਤਿਹਾਸ ਇਹ ਹੈ ਕਿ ਇੱਥੇ ਤਿੰਨ ਸੌ ਪੈਂਹਠ ਪੌੜੀਆਂ ਬਣੀਆਂ ਹੋਈਆਂ ਹਨ ਜਿਨ੍ਹਾਂ ਨੂੰ ਉਤਰ ਕੇ ਅਸੀਂ ਭਗਵਾਨ ਦੇ ਦਰਸ਼ਨ ਕਰਦੇ ਹਾਂ ਅਤੇ ਕਿਹਾ ਜਾਂਦਾ ਹੈ ਕਿ ਇਸ ਨੂੰ ਛੋਟਾ ਹਰਿਦੁਆਰ ਵੀ ਕਿਹਾ ਜਾਂਦਾ ਹੈ ਅਤੇ ਕਿਹਾ ਜਾਂਦਾ ਹੈ ਕਿ ਇੱਥੇ ਪਾਂਡੂ ਆਪਣੇ ਬਨਵਾਸ ਬਾਰਾਂ ਸਮਿਆਂ ਦੇ ਅਗਿਆਤ ਵਾਸ ਦੌਰਾਨ ਆਏ ਸਨ ਅਤੇ ਉਹਨਾਂ ਨੇ ਇੱਥੇ ਕੁਛ ਸਮਾਂ ਬਤੀਤ ਕੀਤਾ ਸੀ ਇਸੇ ਤਰ੍ਹਾਂ ਪਠਾਨਕੋਟ ਦੇ ਇੱਕ ਸ਼ ਇੰਦੋਰੇ ਸ਼ਹਿਰ ਵਿੱਚ ਵੀ ਇੱਕ ਮੰਦਿਰ ਹੈ ਜਿਸ ਜਿਸ ਨੂੰ ਕਾਠਗੜ੍ਹ ਟੈਂਪਲ ਕਿਹਾ ਜਾਂਦਾ ਹੈ ਉਹ ਅਤੇ ਬਹੁਤ ਹੀ ਜ਼ਿਆਦਾ ਫੇਮਸ ਹੈ ਅਤੇ ਉੱਥੋਂ ਦੀਆਂ ਵੀ ਘਟਨਾਵਾਂ ਕਾਫ਼ੀ ਜ਼ਿਆਦਾ ਪ੍ਰਸਿੱਧ ਹਨ ਉੱਥੇ ਸ਼ਿਵਲਿੰਗ ਦੋ ਰੂਪਾਂ ਵਿੱਚ ਰਹਿੰਦੇ ਹਨ ਪਰੰਤੂ ਉਹ ਇੱਕ ਦਿਨ ਸਾਲ ਵਿੱਚ ਮਿਲਦੇ ਹਨ ਜੋ ਕਿ ਅਰਧਨਾਰੇਸ਼ਵਰ ਬਣ ਜਾਂਦੇ ਹਨ ਇਸੇ ਤਰ੍ਹਾਂ ਅਗਰ ਆਪਾਂ ਪਠਾਨਕੋਟ ਵਿੱਚ ਹੋਰ ਚੀਜ਼ਾਂ ਦੀ ਗੱਲ ਕਰੀਏ ਤਾਂ ਇੱਥੇ ਏਸ਼ੀਆ ਦਾ ਸਭ ਤੋਂ ਵੱਡਾ ਮਿਲਟਰੀ ਬੇਸ ਵੀ ਹੈ ਜੋ ਕਿ ਕਾਫ਼ੀ ਜ਼ਿਆਦਾ ਪ੍ਰਸਿੱਧ ਮੰਨਿਆ ਜਾਂਦਾ ਹੈ ਅਤੇ ਪਠਾਨਕੋਟ ਵਿੱਚ ਹੋਰ ਵੀ ਕਈ ਮੰਦਿਰ ਹਨ ਜਿਵੇਂ ਕਿ ਬ ਕਾਲੀ ਮਾਤਾ ਦਾ ਮੰਦਿਰ ਵੀ ਪਠਾਨਕੋਟ ਵਿੱਚ ਬਹੁਤ ਜ਼ਿਆਦਾ ਫੇਮਸ ਹੈ ਅਤੇ ਬਰਫ਼ਾਨੀ ਮੰਦਰ ਵੀ ਪਠਾਨਕੋਟ ਦੇ ਇੱਕ ਬਹੁਤ ਮੰਨਿਆ ਪਰਮੰਨਿਆ ਮੰ ਮੰਦਰ ਹੈ ਪਠਾਨਕੋਟ ਵਿੱਚ ਹੋਰ ਵੀ ਕਈ ਸਾਰੀਆਂ ਚੀਜ਼ਾਂ ਹਨ ਜੋ ਕਿ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈ ਧੰਨਵਾਦ